ਖੇਤ ਸਾਡੇ ਕਲਾ ਖੇਤਰ ਵਿੱਚ ਸ਼ਿਲਪਕਾਰੀ ਖੇਤਰ ਰਾਜ ਵਿੱਚ ਸੱਭਿਆਚਾਰ ਵਿੱਚ ਵਿਰਾਸਤ ਵਿੱਚ ਸਾਡੇ ਜਿੱਦਾਂ ਮਤਲਵ ਦਰੀਆਂ ਲੀਰਾਂ ਦੀਆਂ ਦਰੀਆਂ ਪੁਰਾਣੇ ਕੱਪੜਿਆਂ ਦੀਆਂ ਲੀਰਾਂ ਲੀਰਾਂ ਦੀਆਂ ਦਰੀਆਂ ਬਣਾਉਣੀਆਂ ਯਾਨੀ ਕਿ ਮਿੱਟੀ ਦੇ ਬਰਤਨ ਬਣਾਉਣੇ ਹੋਰ ਯਾਨੀ ਕਿ ਕਿਸ ਤਰ੍ਹਾਂ ਦੇ ਕਲਾਕ੍ਰਿਤੀਆਂ ਕਰਨੀਆਂ ਯਾਨੀ ਕਿ ਬਹੁਤ ਸਾਰਾ ਯੋਗ ਲੋਕ ਯੋਗਦਾਨ ਪਾਉਂਦੇ ਸਨ ਪਰ ਹੋਣੀ ਹੋਣੀ ਇਹ ਅਲੋਪ ਹੋ ਰਿਹਾ ਜਾ ਰਿਹਾ ਹੈ ਯਾਨੀ ਕਿ ਪਹਿਲਾਂ ਪਹਿਲਾਂ ਲੋਕ ਬਹੁਤ ਪਾਉਂਦੇ ਸਨ ਹੁਣ ਵੀ ਕਈ ਕਈ ਜਗ੍ਹਾ ਯਾਨੀ ਕਿ ਚਰਖੇ ਨਾਲ ਰੂਈ ਕੱਤਣੀ ਅੱਜ ਵੀ ਔਰਤਾਂ ਇਹ ਕਰਦੀਆਂ ਹਨ ਅਤੇ ਬੁਣਦੀਆਂ ਹਨ